ਮੇਰੇ ਖੇਤਰ ਦੇ ਵਿੱਚ ਪੰਜ ਤੋਂ ਛੇ ਹਸਪਤਾਲ ਹਨ ਕੁਛ ਹਸਪਤਾਲ ਸਰਕਾਰੀ ਹਨ ਅਤੇ ਕੁਛ ਹਸਪਤਾਲ ਪ੍ਰਾਈਵੇਟ ਹਨ ਜੋ ਸਰਕਾਰੀ ਹਸਪਤਾਲ ਹੈ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੈ ਜਿਸਨੂੰ ਵੀ ਕੋਈ ਬਿਮਾਰੀ ਹੋਵੇ ਉਹ ਸਰਕਾਰੀ ਹਸਪਤਾਲ ਜਾ ਕੇ ਆਪਣਾ ਇਲਾਜ ਕਰ ਸਕਦਾ ਹੈ ਜੋ ਪ੍ਰਾਈਵੇਟ ਹਸਪਤਾਲ ਹਨ ਉਹਨਾਂ 'ਚੋਂ ਕੁਛ ਦਾ ਨਾਮ ਹੈ ਸ਼ੈਲੀ ਨਰਸਿੰਗ ਹੋਮ ਜੋ ਸ਼ੈਲੀ ਨਰਸਿੰਗ ਹੋਮ ਹੈ ਉਹਦੇ ਅੰਦਰ ਡੋਕਟਰ ਜੀ ਕੇ ਸ਼ੈਲੀ ਨਾਮ ਕਰਕੇ ਇੱਕ ਡੋਕਟਰ ਹਨ ਅਤੇ ਉਹ ਲੇਡੀਜ ਡੋਕਟਰ ਨੇ ਅਤੇ ਜੋ ਵੀ ਲੇਡੀਜ ਨੂੰ ਕੋਈ ਵੀ ਪ੍ਰੋਬਲਮ ਹੋਵੇ ਉਹ ਡੋਕਟਰ ਜੀ ਕੇ ਸ਼ੈਲੀ ਨੂੰ ਜਾ ਕੇ ਮਿਲਦੇ ਹਨ ਉਸ ਤੋਂ ਬਾਅਦ ਇੱਕ ਢਿੱਲੋ ਆਈ ਹੋਸਪਿਟਲ ਕਰਕੇ ਇੱਕ ਹਸਪਤਾਲ ਹੈ ਜਿਹਦੇ ਵਿੱਚ ਜੇ ਕਿਸੇ ਨੂੰ ਕੋਈ ਅੱਖਾਂ ਦੀ ਪ੍ਰੋਬਲਮ ਹੈ ਤਾਂ ਉਹ ਡੋਕਟਰ ਨੂੰ ਜਾ ਕੇ ਮਿਲਦੇ ਹਨ ਉਹ ਆਪਣੀ ਪ੍ਰਸਕ੍ਰਿਪਸ਼ਨਸ ਲਿਖ ਦਿੰਦੇ ਨੇ ਅਤੇ ਜਿਹੜਾ ਵੀ ਉੱਥੇ ਜਾ ਜਾਂਦਾ ਹੈ ਉਹ ਆਪਣੀ ਪ੍ਰਸਕ੍ਰਿਪਸ਼ਨਸ ਦੇ ਨਾਲ ਦਵਾਈਆਂ ਲੈ ਕੇ ਵਾਪਸ ਆ ਜਾਂਦਾ ਹੈ ਉਸ ਤੋਂ ਬਾਅਦ ਇੱਕ ਹਸਪਤਾਲ ਹੈ ਸੰਧੂ ਹਸਪਤਾਲ ਅਤੇ ਆਹ ਜੋ ਹਸਪਤਾਲ ਹੈ ਇਹ ਪ੍ਰਸਕ੍ਰਿਪਸ਼ਨਸ ਵੀ ਦਿੰਦੇ ਨੇ ਅਤੇ ਟੈਸਟਸ ਵੀ ਕਰਦੇ ਨੇ ਅਤੇ ਜਿਹੜੇ ਟੈਸਟ ਕਰਦੇ ਨੇ ਉਹ ਸਾਰੇ ਹੀ ਇੰਨਕਲਿਊਡਿਡ ਹੁੰਦੇ ਨੇ ਜਿਵੇਂ ਕਿ ਬਲੱਡ ਟੈਸਟ ਜਾਂ ਸ਼ੂਗਰ ਲੈਵਲ ਚੈੱਕ ਕਰਨਾ ਜਾਂ ਬੀ ਪੀ ਚੈੱਕ ਕਰਨਾ ਉਸ ਤੋਂ ਬਾਅਦ ਇੱਕ ਹਸਪਤਾਲ ਹੈ ਰਾਣਾ ਹਸਪਤਾਲ ਜੋ ਕਿ ਸਰਹਿੰਦ ਬਾਜ਼ਾਰ ਦੇ ਵਿੱਚ ਹੈ ਇੱਥੇ ਵੀ ਸਾਰੀ ਸਬਸਕ੍ਰੈਪਸ਼ਨ ਅਤੇ ਟੈਸਟ ਅਤੇ ਪ੍ਰਸਕ੍ਰਿਪਸ਼ਨਸ ਮਿਲਦੀਆਂ ਨੇ ਉਸ ਤੋਂ ਬਾਅਦ ਜਿਹਨੂੰ ਵੀ ਕੋਈ ਪ੍ਰੋਬਲਮ ਹੋਵੇ ਜੋ ਇਸ ਖੇਤਰ ਦੇ ਹਸਪਤਾਲ ਦੇ ਵਿੱਚ ਨਹੀਂ ਠੀਕ ਹੋ ਸਕਦੀ ਉਹ ਕਿਸੇ ਦੂਸਰੇ ਖੇਤਰ ਵਿੱਚ ਜਾਂਦੇ ਨੇ ਜਿਵੇਂ ਕਿ ਮੋਹਾਲੀ ਦਾ ਕੋਈ ਹਸਪਤਾਲ ਜਾਂ ਪਟਿਆਲਾ ਦਾ ਕੋਈ ਹਸਪਤਾਲ ਇਸ ਸਭ ਦੇ ਬਾਵਜੂਦ ਕਾਫੀ ਕੁਛ ਇਹੋ ਜਿਹੀ ਚੀਜ਼ਾਂ ਹਨ ਜੋ ਇਸ ਖੇਤਰ ਦੇ ਵਿੱਚ ਸਹੀ ਹੋ ਜਾਂਦੀਆਂ ਹਨ